ਸਤਿ ਸ਼੍ਰੀ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਅਨੂੰ ਸ਼ਰਮਾ ਬੋਲ ਰਹੀ ਹਾਂ ਮੈਂ ਕੁਛ ਦਿਨ ਪਹਿਲਾਂ ਮੀਸ਼ੋ ਤੋਂ ਇੱਕ ਕਰੋਕਰੀ ਸੈੱਟ ਮੰਗਵਾਇਆ ਸੀ ਉਹ ਜੋ ਕੀ ਮੈਨੂੰ ਮੇਰੇ ਟਾਈਮ ਪੀਰੀਅਡ ਦੇ ਅਕੋਡਿੰਗ ਹੀ ਮੈਨੂੰ ਮਿਲ ਗਿਆ ਸੀ ਔਰ ਜੋ ਕੀ ਮਾਰਕਿਟ ਪ੍ਰਾਈਜ਼ ਦੇ ਵਿੱਚ ਦਸ ਹਜ਼ਾਰ ਦਾ ਸੀ ਅਤੇ ਮੈਨੂੰ ਮੀਸ਼ੋ ਤੋਂ ਪੰਜ ਹਜ਼ਾਰ ਕੁਛ ਰੁਪਏ ਦਾ ਮਿਲਿਆ ਇਹ ਕਰੋਕਰੀ ਸੈੱਟ ਬਹੁਤ ਹੀ ਅੱਛਾ ਔਰ ਬਹੁਤ ਹੀ ਵਧੀਆ ਕੁਆਲਿਟੀ ਦਾ ਸੀ ਜਿਸ ਤਰ੍ਹਾਂ ਦਾ ਮੈਂ ਆਮ ਵੈਬਸਾਈਟਸ 'ਤੇ ਦੇਖ ਰਹੀ ਹੁੰਦੀ ਹਾਂ ਬਟ ਉਹਦੇ ਨਾਲੋਂ ਬਹੁਤ ਜ਼ਿਆਦਾ ਕਫ਼ਾਇਤੀ ਔਰ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਸੀ ਮ ਇਹ ਪ੍ਰੋਡਕਟ ਮੇਰੇ ਘਰ ਆਇਆ ਅਤੇ ਮੇਰੇ ਘਰਦੇ ਵੀ ਬਹੁਤ ਖੁਸ਼ ਹੋਏ ਅਤੇ ਇਸ ਨੂੰ ਦੇਖ ਕੇ ਮੈਨੂੰ ਵੀ ਬਹੁਤ ਤਸੱਲੀ ਹੋਈ ਕਿਉਂਕਿ ਜਿਸ ਤਰ੍ਹਾਂ ਦਾ ਮੈਂ ਕਰੋਕਰੀ ਸੈੱਟ ਚਾਹੁੰਦੀ ਸੀ ਉਸੇ ਤਰ੍ਹਾਂ ਦਾ ਉਹ ਮੈਨੂੰ ਕਰੋਕਰੀ ਸੈੱਟ ਮੈਨੂੰ ਮੈਨੂੰ ਪ੍ਰਾਪਤ ਹੋਇਆ ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਰਹੂੰ ਕਰਦੀ ਹਾਂ ਔਰ ਅੱਗੇ ਤੋਂ ਮੈਂ ਆਸ਼ਾ ਕਰਦੀ ਹਾਂ ਕਿ ਮੈਂ ਇਸ ਕੰਪਨੀ ਨਾਲ ਜੁੜੀ ਰਹਾਂ ਔਰ ਜੋ ਵੀ ਸਮਾਨ ਗਾਹਾਂ ਤੋਂ ਮੰਗਵਾਉਣਾ ਚਾਹੂੰਗੀ ਔਰ ਮੈਂ ਇਸ ਤੋਂ ਹੀ ਇਹ ਮੰਗਵਾਵਾਂ ਧੰਨਵਾਦ